ਗਤਕਾ ਅਤੇ ਹੋਰ ਬਹੁਤ ਖੇਡਾਂ ਅਲੋਪ ਹੋ ਰਹੀਆਂ ਪਰ ਇਹਨਾਂ ਦੀ ਸੰਭਾਲ ਪ੍ਰਸਾਰ ਲਈ ਬਹੁਤ ਸਾਰੇ ਹੱਲ ਵੀ ਕੱਢੇ ਜਾ ਰਹੇ ਆ ਜਿਵੇਂ ਕਿ ਹੁਣ ਇਸ ਵਿਰਾਸਤੀ ਖੇਡ ਦਾ ਪ੍ਰਚਾਰ ਵੀ ਬਹੁਤ ਹੋ ਰਿਹਾ ਪੰਚਾਇਤਾਂ ਇਸ ਲਈ ਨੌਜਵਾਨ ਉਤਸ਼ਾਹਿਤ ਕਰ ਰਹੀਆਂ ਹਨ ਅਤੇ ਇਸ ਦੇ ਹੁਣ ਮੁਕਾਬਲੇ ਵੀ ਹੁੰਦੇ ਹਨ ਜਿਵੇਂ ਕਿ ਨਗਰ ਕੀਰਤਨਾਂ ਦੇ ਵਿੱਚ ਵੀ ਸਾਨੂੰ ਗਤਕਾ ਕਰਕੇ ਵਿਖਾਇਆ ਜਾਂਦਾ ਹੈ ਅਤੇ ਸਟੇਟ ਸੈਂਟਰ ਲੈਵਲ 'ਤੇ ਵੀ ਹੁੰਦੇ ਹਨ ਗਤਕਾ ਖੇਡਣ ਨਾਲ ਬਹੁਤ ਹੀ ਲਾਭ ਹੁੰਦੇ ਹਨ ਜਿਵੇਂ ਕਿ ਸਿਹਤ ਬਣਦੀ ਹੈ ਅਤੇ ਇਸ ਨਾਲ ਅਸੀਂ ਆਪਣੀ ਰੱਖਿਆ ਆਪ ਕਰ ਸਕਦੇ ਹਾਂ ਖਾਸ ਕਰਕੇ ਲੜਕੀਆਂ ਲਈ ਇਹ ਗੱਤਕਾ ਸਿਖਣਾ ਬਹੁਤ ਜ਼ਰੂਰੀ ਹੈ ਕਿ ਉਹ ਆਪਣੀ ਰੱਖਿਆ ਆਪ ਕਰ ਸਕਣ ਅਤੇ ਅੱਗੇ ਵਧ ਸਕਣ